ਮੈਂ ਥੋਨੂੰ ਭੰਗੜੇ ਦੇ ਆਮ ਸਟੈਪ ਦੱਸਣਾ ਚਾਹੁੰਨੀ ਆਂ ਸਭ ਤੋਂ ਜਿਹੜਾ ਮਸ਼ਹੂਰ ਸਟੈਪ ਐ ਧਮਾਲ ਉਹਦੇ ਮੂਮੈਂਟ ਹਨ ਜਿਵੇਂ ਇਹ ਸਭ ਤੋਂ ਮਸ਼ਹੂਰ ਭੰਗੜਾ ਸਟੈਪਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਜਿਸ ਵਿੱਚ ਕੀ ਆ ਲੱਤਾਂ ਬਾਹਾਂ ਚੋੜੀਆਂ ਕਰਕੇ ਹਰਕਤਾਂ ਸ਼ਾਮਲ ਹੁੰਦੀਆਂ ਹਨ ਅਕਸਰ ਇਸ ਵਿੱਚ ਛਾਲਾਂ ਮਾਰ ਕੇ ਨੱਚਿਆ ਜਾਂਦਾ ਹੈ ਡਾਂਸਰ ਜਮੀਨ ਤੇ ਸਟੈਂਪਿੰਗ ਕਰਦੇ ਹੋਏ ਆਪਣੀਆਂ ਬਾਹਾਂ ਨੂੰ ਗੋਲਾ ਕਾਰ ਮੋਸ਼ਨ ਵਿੱਚ ਸਵਿੰਗ ਕਰਦੇ ਹਨ ਤੇ ਜਦੋਂ ਇਹ ਭੰਗੜਾ ਪਾਉਂਦੇ ਹਨ ਤੇ ਦੇਖਣ ਵਾਲੇ ਨੂੰ ਵੀ ਬਹੁਤ ਹੀ ਅੱਛਾ ਲੱਗਦਾ ਹੈ ਧਮਾਲ ਦਾ ਬਹੁਤ ਹੀ ਜਿਆਦਾ ਯੋਗਦਾਨ ਹੈ ਧਮਾਲ ਜੋਸ਼ ਅਤੇ ਆਨੰਦ ਨੂੰ ਦਰਸਾਂਦਾ ਹੈ ਸ਼ਕਤੀਸ਼ਾਲੀ ਸਟਿਪਿੰਗ ਅਤੇ ਚੋੜੇ ਬਾਹਾਂ ਦੇ ਝੂਲੇ ਪੰਜਾਬੀ ਜਸ਼ਨਾਂ ਦੀ ਸ਼ਾਨਦਾਰ ਭਾਵਨਾਵਾਂ ਦੇ ਪ੍ਰਤੀਕ ਹਨ ਏਕਤਾ ਅਤੇ ਸਮੂਹਿਕ ਖੁਸ਼ੀ ਦੀ ਭਾਵਨਾ ਪੈਦਾ ਕਰਦੇ ਹਨ ਭੰਗੜਾ ਭਾਰਤ ਅਤੇ ਪਾਕਿਸਤਾਨ ਦੇ ਪੰਜਾਬ ਖੇਤਰ ਤੋਂ ਉਤਪਨ ਹੋਇਆ ਹੈ ਇੱਕ ਜੀਵੰਤ ਅਤੇ ਊਰਜਾਵਾਨ ਲੋਕ ਨਾਚ ਪੰਜਾਬੀ ਸੱਭਿਆਚਾਰ ਨਾਲ ਡੂੰਘਾ ਜੁੜਿਆ ਹੋਇਆ ਹੈ ਧੰਨਵਾਦ